ਪੰਜਾਬ ਵਿੱਚ ਵਾਧੂ ਸਾਰੇ ਮਸ਼ਹੂਰ ਭੰਗੜੇ ਦੇ ਗੀਤ ਹਨ ਅਲੱਗ ਅਲੱਗ ਕਲਾਕਾਰਾਂ ਦੇ ਜਿਵੇਂ ਕਿ ਦਿਲਜੀਤ ਦੋਸਾਂਝ ਗਿੱਪੀ ਗਰੇਵਾਲ ਅਤੇ ਹੋਰ ਵੀ ਆਰਟਿਸਟ ਹਨ ਜਿਹਨਾਂ ਦੇ ਮਸ਼ਹੂਰ ਗਾਣੇ ਹਨ ਭੰਗੜੇ ਦੇ ਲਈ ਅਤੇ ਬੰਦਿਆਂ ਨੂੰ ਕਈ ਵਾਰ ਅਲੱਗ ਕਿਸਮ ਦੇ ਭੰਗੜੇ ਦੇ ਗਾਣੇ ਸੋਹਣੇ ਲੱਗਦੇ ਹਨ ਜਦੋਂ ਕਿ ਬੁੱਢੀਆਂ ਨੂੰ ਅਲੱਗ ਪਸੰਦ ਆਉਂਦੇ ਹਨ ਅਤੇ ਮੇਰਾ ਮਨ ਪਸੰਦੀਦਾ ਗੀਤ ਹੈਗਾ ਨੱਚਦੀਆਂ ਅੱਲੜਾਂ ਕਵਾਰੀਆਂ ਜਿਹੜਾ ਕਿ ਦਿਲਜੀਤ ਦੋਸਾਂਝ ਦੁਆਰਾ ਗਾਇਆ ਗਿਆ ਹੈ ਇਸ ਗੀਤ ਨੂੰ ਬਹੁਤ ਹੀ ਮਸ਼ਹੂਰ ਦੱਸਿਆ ਗਿਆ ਹੈ ਕਿਉਂਕਿ ਇਸ ਗੀਤ 'ਤੇ ਸਾਰੇ ਜਾਣੇ ਨੱਚ ਪੈਂਦੇ ਹਨ ਖਾਸਕਰ ਇਹ ਗੀਤ ਬੁੱਢੀਆਂ ਨੂੰ ਜ਼ਿਆਦਾ ਪਸੰਦ ਆਉਂਦਾ ਹੈ ਕਿਉਂਕਿ ਗਾਣੇ ਦੇ ਵਿੱਚ ਇਹੀ ਜ਼ਿਆਦਾਤਰ ਚਲਾਇਆ ਜਾਂਦਾ ਹੈ ਅਤੇ ਬੁੱਢੀਆਂ ਰੱਜ ਕੇ ਇਸ ਗਾਣੇ ਦੇ ਉੱਤੇ ਭੰਗੜਾ ਪਾਉਂਦੀਆਂ ਹਨ ਅਤੇ ਖੁਸ਼ ਹੁੰਦੀਆਂ ਹਨ ਜ਼ਿਆਦਾਤਰ ਇਹ ਗੀਤ ਵਿਆਹਾਂ 'ਚ ਚਲਾਇਆ ਜਾਂਦਾ ਹੈ ਅਤੇ ਮੈਨੂੰ ਇਹ ਗੀਤ ਬਹੁਤ ਪਸੰਦ ਹੈ ਜਦੋਂ ਵੀ ਇਸ ਗਾਣੇ ਨੂੰ ਸੁਣਦੀ ਹਾਂ ਇੱਕ ਅਜੀਬ ਅਜੀਬ ਹੀ ਲਹਿਰ ਮੇਰੇ ਅੰਦਰ ਉੱਠ ਜਾਂਦੀ ਅਤੇ ਮੈਂ ਆਪ ਹੀ ਨੱਚਣ ਲੱਗ ਜਾਂਦੀ ਹਾਂ